ਹੈਲੋ ਸਰ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਗੱਲ ਕਰ ਰਹੀ ਹਾਂ ਨਵੀਆਂ ਤਕਨੀਕਾਂ ਬਾਰੇ ਵੀ ਵੀ ਵਿਗਿਆਨ ਨੇ ਕਿੰਨੀ ਤਰੱਕੀ ਕਰ ਰਹੀ ਆ ਪਹਿਲਾਂ ਵਾਲੇ ਟਾਈਮ ਦੀ ਗੱਲ ਕਰਦੇ ਹਾਂ ਆਪਾਂ ਵੀ ਉਦੋਂ ਹੱਥੀਂ ਦਰੀਆਂ ਵਗੈਰਾ ਬੁਣੀਆਂ ਜਾਂਦੀਆਂ ਸੀ ਅੱਡੇ ਲਗਾਏ ਜਾਂਦੇ ਸੀਗੇ ਉਸ ਟੈਮ ਕੋਈ ਮਸ਼ੀਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ ਘਰਾਂ ਦੀਆਂ ਔਰਤਾਂ ਇਕੱਠੀਆਂ ਹੋ ਕੇ ਇੱਕ ਘਰ ਅੱਡੇ ਲਾਉਂਦੀਆਂ ਉੱਥੇ ਪਹਿਲਾਂ ਤਾਣਾ ਪਾਉਂਦੀਆਂ ਦਰ ਦਰੀ ਦਾ ਤਾਣਾ ਪਾਉਂਦੀਆਂ ਫਿਰ ਸੂਤ ਵਾਲੀ ਦਰੀ ਬੁਣਦੀਆਂ ਲੀਰਾਂ ਵਾਲੀਆਂ ਦਰੀਆਂ ਬੁਣਦੀਆਂ ਉਵੇਂ ਦਰੀਆਂ ਤਿਆਰ ਕੀਤੀਆਂ ਜਾਂਦੀਆਂ ਸੀ ਦਰੀਆਂ ਲਾ ਲਓ ਤੁਸੀਂ ਖੇਸ ਲਾ ਲਓ ਕੁਛ ਮਰਜ਼ੀ ਲਾ ਸਕਦੇ ਹਾਂ ਜਿਹੜੇ ਕਿ ਹੁਣ ਆਪਾਂ ਇਸ ਟੈਮ ਵਿੱਚ ਉਹਨਾਂ ਦੀ ਵਰਤੋਂ ਕਰਦੇ ਹਾਂ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਸਰ ਜੋ ਤੁਸੀਂ ਕਹਿ ਰਹੇ ਹੋ ਉਹ ਵੀ ਹਾਂਜੀ ਸਰ ਪਰ ਉਹ ਹੁਣ ਦੇ ਜ਼ਮਾਨੇ ਦੀ ਸਰ ਆ ਹਾਂਜੀ ਗੱਲ ਕਰੀਏ ਤਾਂ ਜਦੋਂ ਵੀ ਹੁਣ ਕੋਈ ਦਰੀ ਜਾਂ ਕੋਈ ਬੁਣਨਾ ਹੋਵੇ ਹੁਣ ਤਾਂ ਨਵੀਆਂ ਤੋਂ ਨਵੀਆਂ ਤਕਨੀਕਾਂ ਆਈਆਂ ਹੋਈਆਂ ਸਾਰੀ ਮਸ਼ੀਨਾਂ ਰਾਹੀਂ ਮਸ਼ੀਨਾਂ ਦੀ ਵਰਤੋਂ ਕਰਕੇ ਦਰੀਆਂ ਖੇਸ ਚਾਦਰਾਂ ਬਣਾਉਂਦੇ ਆ ਪਹਿਲਾਂ ਵਾਲੇ ਸ ਹਾਂਜੀ ਸਰ ਹੁਣ ਵਾਲੇ ਟਾਈਮ ਵਿੱਚ ਜਦੋਂ ਵੀ ਕੋਈ ਦਰੀ ਜਾਂ ਬਣਵਾਉਣੀ ਬਣਾਉਣੀ ਹੁੰਦੀ ਆ ਪਹਿਲਾਂ ਟਾਈਮ ਵਿੱਚ ਮਹੀਨਾ ਮਹੀਨਾ ਵੀਹ ਵੀਹ ਦਿਨ ਲੱਗ ਜਾਂਦੇ ਸੀ ਇੱਕ ਦਰੀ ਨੂੰ ਬਣਾਉਣ ਵਾਸਤੇ ਪਰ ਜੇ ਆਪਾਂ ਹੁਣ ਦੇ ਟਾਈਮ ਦੀ ਗੱਲ ਕਰੀਏ ਵਿਗਿਆਨ ਐਨੀ ਤਰੱਕੀ ਕਰ ਰਹੀ ਹੈ ਕਿ ਉਹ ਆਪਾਂ ਸਿਰਫ ਕੁਛ ਦੋ ਜਾਂ ਦੋ ਜਾਂ ਤਿੰਨ ਦਿਨਾਂ ਵਿੱਚ ਵੀ ਜ਼ਿਆਦਾ ਹੋ ਰਿਹਾ ਇੱਕ ਦਿਨ ਤੱਕ ਵੀ ਕੰਪਲੀਟ ਹੋ ਜਾਂਦੀ ਹੈ ਕਿਉਂਕਿ ਆਪਣੇ ਸਾਇੰਸ ਨੇ ਇੰਨੀ ਤਰੱਕੀ ਕਰ ਚੁੱਕੇ ਇੰਨੀਆਂ ਵੀ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਬਣਾ ਲਈਆਂ ਬਈ ਥੋੜ੍ਹੇ ਕੁ ਟਾਈਮ ਵਿੱਚ ਉਹ ਕੰਮ ਨੂੰ ਕਰ ਦਿੰਦੇ ਆ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਸਰ ਜੋ ਤੁਸੀਂ ਕਹਿ ਰਹੇ ਹੋ ਉਹ ਵੀ ਠੀਕ ਆ ਹਾਂਜੀ ਸਰ ਪਹਿਲਾਂ ਵਾਲੇ ਟਾਈਮ ਵਿੱਚ ਜਿਹੜੀ ਜੋ ਹੱਥੀਂ ਕੰਮ ਕੀਤਾ ਜਾਂਦਾ ਸੀ ਉਹਦੇ ਵਰਗੀ ਸਫਾਈ ਨਹੀਂ ਹੁੰਦੀ ਸੀ ਕਿਉਂਕਿ ਉਹਦੇ ਉੱਪਰ ਨਵੇਂ ਤੋਂ ਨਵੇਂ ਡਿਜ਼ਾਇਨ ਬਣਾ ਕੇ ਕੋਈ ਫੁੱਲ ਉਹ ਕੋਈ ਕੋਈ ਚਿੜੀਆਂ ਵਗੈਰਾ ਕੋਈ ਤੁਸੀਂ ਵੀ ਕਿਸੇ ਮਰਜ਼ੀ ਤਰ੍ਹਾਂ ਆਪਾਂ ਡਿਜ਼ਾਇਨ ਬਣਵਾ ਸਕਦੇ ਸੀ ਉਸ ਡਿਜ਼ਇਨ ਦੀ ਸਫਾਈ ਵੀ ਬਹੁਤ ਆਉਂਦੀ ਸੀ ਅਤੇ ਉਹਦੇ 'ਤੇ ਮਿਹਨਤ ਵੀ ਬਹੁਤ ਕੀਤੀ ਜਾਂਦੀ ਸੀ ਪਰ ਹੁਣ ਦੇ ਟਾਈਮ ਬਈ ਦੀ ਆਪਾਂ ਗੱਲ ਕਰੀਏ ਤਾਂ ਨਵੀਂ ਤੋਂ ਨਵੀਂ ਨਵੀਂ ਮਸ਼ੀਨ ਆਈ ਹੋਈ ਆ ਉਹਦੇ ਵਿੱਚ ਕੋਈ ਮਰਜ਼ੀ ਡਿਜ਼ਾਇਨ ਪਾਓ ਅਤੇ ਉਹ ਆਪਣੇ ਸਾਹਮਣੇ ਕੋਪੀ ਹੋ ਕੇ ਆ ਜਾਂਦਾ ਸੇਮ ਬਣ ਕੇ ਆ ਜਾਂਦਾ ਹਾਂਜੀ ਸਰ ਹਾਂਜੀ ਹਾਂਜੀ ਤੁਸੀਂ ਆ ਕਢਾਈ ਵਾਲੀ ਮਸ਼ੀਨਾਂ ਦੀ ਗੱਲ ਕਰ ਲਓ ਪਹਿਲਾਂ ਵਾਲੇ ਸਮੇਂ ਵਿੱਚ ਜਦੋਂ ਵੀ ਕਢਾਈ ਕੀਤੀ ਜਾਂਦੀ ਸੀ ਉਦੋਂ ਹੱਥੀਂ ਹੱਥੀਂ ਕਢਾਈ ਕੀਤੀ ਆ ਜੀ ਥ੍ਰਰੈੱਡ ਵਰਕ ਕੀਤਾ ਜਾਂਦਾ ਸੀ ਹੱਥੀ ਕਿਉਂਕਿ ਉਸ ਟੈਮ ਉਸ ਚੀਜ਼ ਨੂੰ ਕਰਨ ਲਈ ਕਾਫੀ ਟੈਮ ਲੱਗਦਾ ਸੀ ਪਰ ਜੇ ਹੁਣ ਦੇ ਸਮੇਂ ਦੀ ਗੱਲ ਕਰੀਏ ਤਾਂ ਨਵੀਂ ਕਢਾਈ ਵਾਲੀਆਂ ਮਸ਼ੀਨਾਂ ਚੱਲ ਪਈਆਂ ਸਟਿਚਿੰਗ ਵਾਲੀਆਂ ਮਸ਼ੀਨਾਂ ਚੱਲ ਪਈਆਂ ਕਢਾਈ ਵਾਲੀ ਮਸ਼ੀਨ 'ਚ ਵੀ ਇੱਕ ਵਾਰੀ ਡਿਜ਼ਾਇਨ ਪਾਓ ਨੀਚੇ ਕੱਪੜਾ ਰੱਖੋ ਅਤੇ ਉਸਨੂੰ ਅੱਧੇ ਘੰਟੇ ਵਿੱਚ ਇਹ ਡਿਜ਼ਾਇਨ ਬਣਾ ਕੇ ਪ੍ਰੋਪਰ ਤਿਆਰ ਕਰਕੇ ਦੇ ਦਿੰਦੀ ਆ ਹਾਂਜੀ ਸਰ ਹਾਂਜੀ ਹਾਂਜੀ ਵੀ ਆਪਾਂ ਕਿਵੇਂ ਤਰ੍ਹਾਂ ਦਾ ਮਰਜ਼ੀ ਡਿਜ਼ਾਇਨ ਤਿਆਰ ਕਰ ਸਕਦੇ ਹਾਂ ਹਾਂਜੀ ਸਰ ਹਾਂਜੀ ਹਾਂਜੀ ਵੀ ਨਵੀਂ ਤੋਂ ਨਵੀਂ ਤਕਨੀਕ ਆ ਰਹੀ ਹੈ ਹੁਣ ਦੇ ਜ਼ਮਾਨੇ ਵਿੱਚ ਵੀ ਪਹਿਲਾਂ ਲੋਕ ਸਾਰੇ ਜਿਹੜੇ ਹੱਥੀਂ ਕੰਮ ਕਰਦੇ ਸੀ ਪਰ ਹੁਣ ਤਾਂ ਮਸ਼ੀਨਾਂ ਵੀ ਆ ਗਈਆਂ ਹੁਣ ਤਾਂ ਤੁਸੀਂ ਮਤਲਬ ਦੇਖੋ ਕੋਈ ਗੱਤੇ ਵਾਲੀ ਮਸ਼ੀਨ ਬਣਵਾਉਣੀ ਹੋਵੇ ਬਈ ਪਹਿਲਾਂ ਤਾਂ ਲੋਕ ਵੀ ਘਰ ਬੈਠੇ ਉਹ ਨੋਰਮਲ ਚੀਜ਼ਾਂ ਵੀ ਪੈਕਿੰਗ ਕਰ ਲੈਂਦੇ ਸੀ ਪਰ ਹੁਣ ਦੇ ਟਾਈਮ ਵਿੱਚ ਨਵੀਆਂ ਤੋਂ ਨਵੀਆਂ ਚੀਜ਼ਾਂ ਤਕਨੀਕਾਂ ਆ ਰਹੀਆਂ ਲੋਕ ਡੱਬਿਆਂ ਵਿੱਚ ਪੈਕ ਕਰ ਕਰ ਕੇ ਭੇਜਦੇ ਹੈਗੇ ਹਾਂਜੀ ਸਰ ਪਹਿਲਾਂ ਵਾਲੇ ਟਾਈਮ ਵਿੱਚ ਤੁਸੀਂ ਦੇਖੋ ਵੀ ਚੁੱਲ੍ਹੇ ਉੱਪਰ ਰੋਟੀ ਬਣਾਈ ਜਾਂਦੀ ਸੀ ਪਰ ਉਹ ਹੁਣ ਦੇ ਜ਼ਮਾਨੇ ਵਿੱਚ ਗੈਸ ਵਗੈਰਾ ਆ ਰਹੇ ਨਵੀਂ ਤੋਂ ਨਵੀਂ ਤਕਨੀਕ ਆ ਰਹੀ ਹੈ ਨਾ ਵੀ ਆਪਾਂ ਵੀ ਕਿਵੇਂ ਚੀਜ਼ ਉਹਨੂੰ ਹੈਂਡਲ ਕਰ ਰਹੇ ਹਾਂ ਚੀਜ਼ ਨੂੰ ਵੀ ਦੁਨੀਆਂ ਨੂੰ ਵੀ ਵਿਗਿਆਨ ਨੇ ਇੰਨੀ ਸੁੱਖ ਸਹੂਲਤ ਦੇ ਦਿੱਤੀ ਵੀ ਸੌਖਾ ਕਰਤਾ ਹਾਂਜੀ ਸਰ ਬਸ ਵੀ ਸਰ ਹਾਂਜੀ ਤੁਸੀਂ ਵੀ ਜੋ ਕਹਿ ਰਹੇ ਹੋ ਸਹੀ ਹੈ ਸਰ ਹਾਂਜੀ ਹਾਂਜੀ ਐਵੇਂ ਵੀ ਹੋ ਸਕਦਾ ਹਾਂਜੀ ਬਾਕੀ ਸਰ ਵੀ ਮੈਂ ਤਾਂ ਇੰਨਾ ਕਹਿ ਰਹੀ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੀ ਆ ਜਿਹਦੇ ਕਾਰਨ ਆਪਣੇ ਵਰਗੇ ਨੋਰਮਲ ਇਨ ਵੀ ਇਨਸਾਨ ਤੋਂ ਵੀ ਸੌਖਾ ਹੋ ਗਿਆ ਕਿ ਜਿਹਨਾਂ ਨੂੰ ਕੰਮ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ ਅਤੇ ਆਪਦਾ ਘੱਟ ਟਾਈਮ ਵਿੱਚ ਕੰਮ ਕਰ ਸਕਦੇ ਆ ਥੈਂਕ ਯੂ ਸੋ ਮੱਚ ਸਰ